ਸਾਡਾ ਫਾਰਮ ਅਸੀਂ ਆਪਣੇ ਫਾਰਮ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਲਗਾਈਆਂ ਹੋਈਆਂ ਨੇ ਬਹੁਤ ਸਾਰੇ ਫਲਾਂ ਦੇ ਬੂਟੇ ਲਗਾਏ ਹੋਏ ਨੇ ਕਿਉਂਕਿ ਅਸੀਂ ਸਬਜ਼ੀਆਂ ਆਪਣੇ ਘਰ ਦੀਆਂ ਹੀ ਵਰਤਦੇ ਹਾਂ ਅਤੇ ਫਲ ਹੀ ਆਪਣੇ ਘਰ ਦੇ ਵਰਤਦੇ ਹਾਂ ਆਪਣੀ ਸਿਹਤ ਨੂੰ ਖਿਆਲ ਰੱਖਣ ਲਈ ਇਸ ਲਈ ਜਿਵੇਂ ਕਿ ਦਾਲਾਂ ਮਸਾਲੇ ਹਲਦੀ ਉਹ ਅਸੀਂ ਘਰ ਹੀ ਆਪਣੇ ਫਾਰਮ 'ਤੇ ਲਗਾਏ ਹੋਏ ਨੇ ਅਤੇ ਇਸ ਲਈ ਸਾਨੂੰ ਆਪਣਾ ਕੰਮ ਆਪਣੇ ਫਾਰਮ 'ਤੇ ਆਪਣਾ ਕੰਮ ਕਰਨ ਦਾ ਬਹੁਤ ਹੀ ਮਜ਼ਾ ਆਉਂਦਾ ਹੈ ਸਾਡੀ ਸਿਹਤ ਵੀ ਵਧੀਆ ਰਹਿੰਦੀ ਹੈ ਤੰਦਰੁਸਤੀ ਮਿਲਦੀ ਹੈ ਸਾਡੀ ਸਿਹਤ ਦੀ ਕਸਰਤ ਵੀ ਹੁੰਦੀ ਹੈ ਜਿਵੇਂ ਕਿ ਅਸੀਂ ਕੁਝ ਪਲਾਂਟ ਮੈਡੀਸਨ ਦੇ ਵੀ ਲਗਾਏ ਲਾਏ ਹੋਏ ਨੇ ਉਹ ਵੀ ਸਾਨੂੰ ਫਾਇਦੇਮੰਦ ਨੇ ਜੋ ਸਾਨੂੰ ਸਾਰਾ ਆਪਣੇ ਫਾਰਮ ਤੋਂ ਹੀ ਮਿਲ ਜਾਂਦਾ ਹੈ ਜਿਵੇਂ ਕਿ ਮੱਝਾਂ ਗਾਵਾਂ ਰੱਖੀਆਂ ਹੋਈਆਂ ਨੇ ਜਿਸ ਤਰ੍ਹਾਂ ਦੁੱਧ ਵੀ ਅਸੀਂ ਆਪਣੇ ਫਾਰਮ ਤੋਂ ਹੀ ਲੈ ਕੇ ਆਉਂਦੇ ਹਾਂ ਸਾਡਾ ਘਰ ਦਾ ਹੀ ਦੁੱਧ ਹੁੰਦਾ ਹੈ ਸਾਨੂੰ ਆਪਣਾ ਕੰਮ ਕਰਨਾ ਬੜਾ ਹੀ ਵਧੀਆ ਲੱਗਦਾ ਹੈ ਅਤੇ ਸਾਡੀ ਸਿਹਤ ਵੀ ਵਧੀਆ ਰਹਿੰਦੀ ਹੈ